ਕਲਾ ਅਤੇ ਸ਼ਿਲਪਕਾਰੀ ਖੇਤਰ ਪੰਜਾਬ ਵਿੱਚ ਕਲਾ ਅਤੇ ਸ਼ਿਲਪਕਾਰੀ ਦੀ ਖਪਤ ਵਿੱਚ ਪਹੁੰਚ ਜਾਂ ਸਮਰੱਥਾ ਦੇ ਮੁੱਦੇ ਨੂੰ ਹੱਲ ਕਰਦਾ ਹੈ ਕਿਉਂਕਿ ਸਰਕਾਰ ਦੁਆਰਾ ਹੀ ਇਹ ਮੇਲੇ ਲੱਗਦੇ ਹੈ ਜਿਹਦੇ ਵਿੱਚ ਇੱਕ ਤਰ੍ਹਾਂ ਤਰ੍ਹਾਂ ਦੇ ਪ੍ਰਾਂਤਾਂ ਤੋਂ ਲੋਕ ਆਉਂਦੇ ਹੈ ਜਿਹੜੀਆਂ ਆਪਣੀਆਂ ਸ਼ਿਲਪਕਾਰੀਆਂ ਵਿਖਾਉਂਦੇ ਹੈ ਜਿੱਥੋਂ ਲੋਕਾਂ ਨੂੰ ਵੱਖਰੀ ਵੱਖਰੀ ਕਲਾ ਵੇਖਣ ਨੂੰ ਮਿਲਦੀ ਹੈ ਔਰ ਲੋਕ ਅਵੇਅਰੈਂਸ ਹੁੰਦੇ ਹੈ ਔਰ ਕਈ ਲੋਕ ਖਰੀਦਦੇ ਵੀ ਹੈ ਔਰ ਲੋਕ ਸਰਕਾਰ ਅਵੇਅਰੈਂਸ ਪ੍ਰੋਗਰਾਮ ਵੀ ਕਰਦੀ ਹੈ ਜਿੱਥੋਂ ਸਾਨੂੰ ਲੋਕਾਂ ਦੀ ਕਲਾ ਵੇਖਣ ਨੂੰ ਮਿਲਦੀ ਹੈ ਹਾਂਜੀ ਅਤੇ ਉੱਥੋਂ ਉਹਨਾਂ ਨੂੰ ਸਰਕਾਰ ਨੂੰ ਵੀ ਫਾਇਦਾ ਹੁੰਦਾ ਹੈ ਅਤੇ ਲੋਕਾਂ ਦੀ ਮੇਲਿਆਂ ਵਾਲੀ ਜਿਹੜੇ ਲੋਕ ਲਾਂਦੇ ਹੈ ਉਹਨਾਂ ਉਹਨਾਂ ਦੀ ਵੀ ਕਮਾਈ ਦਾ ਸਾਧਨ ਅੱਛਾ ਵੈ ਜਿੱਦਾਂ ਸੋਲਰ ਸਿਮਟਮ ਹੈ ਲੋਕ ਸੋਲਰ ਸਿਮਟਮ ਲਗਾਉਂਦੇ ਹੈ ਅਤੇ ਸਰਕਾਰ ਉਹਨਾਂ ਨੂੰ ਸਬਸਿਡੀ ਦਿੰਦੀ ਹੈ ਫਿਫਟੀ ਪਰਸੈਂਟ ਉਹ ਵੀ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਮੇਲਿਆਂ ਤੋਂ ਵੀ ਲੋਕਾਂ ਨੂੰ ਕਾਫੀ ਜਾਗਰੂਕਤਾ ਮਿਲਦੀ ਹੈ ਕਾਫੀ ਚੀਜ਼ਾਂ ਵੇਖਣ ਨੂੰ ਆਉਂਦੀਆਂ ਜਿਹੜੀਆਂ ਪਿਛੋਕੜ ਦੀਆਂ ਚੀਜ਼ਾਂ ਅਸੀਂ ਪਿਛੋੜ ਚੁੱਕੇ ਹੁੰਦੇ ਹਾਂ ਜਿਹੜੇ ਬੱਚੇ ਜਿਹੜੀਆਂ ਚੀਜ਼ਾਂ ਤੋਂ ਸਾਡੇ ਬੱਚੇ ਜਾਣੂ ਨਹੀਂ ਹੈ ਉਹ ਵੀ ਬੱਚੇ ਸਾਡੀਆਂ ਚੀਜ਼ਾਂ ਤੋਂ ਜਾਣੂ ਹੁੰਦੇ ਹੈ ਕਈ ਚੀਜ਼ਾਂ ਸਾਡੇ ਟਾਈਮ 'ਤੇ ਸੀ ਅੱਜ ਕੱਲ੍ਹ ਟਾਈਮ 'ਚ ਲੁਪਤ ਹੋ ਜਾ ਰਹੀਆਂ ਹੈ ਮੇਲਿਆਂ 'ਚ ਉਹ ਵੀ ਦੇਖਣ ਨੂੰ ਮਿਲਦੀਆਂ ਹੈ ਕਈ ਬੱਚੇ ਆਪਣਾ ਹੁਨਰ ਹੀ ਛੱਡ ਦਿੰਦੇ ਹੈ ਲੇਕਿਨ ਸਰਕਾਰ ਉਹਨਾਂ ਨੂੰ ਸਬਸਿਡੀ ਦੇ ਦੁਆਰਾ ਉਹਨਾਂ ਨੂੰ ਆਪਣਾ ਹੁਨਰ ਜਾਗਰੂਕ ਕਰਨ ਦੀ ਪ੍ਰੇਰਨਾ ਦਿੰਦੀ ਹੈ ਔਰ ਆਪਣਾ ਹੁਨਰ ਜਾਗਰੂਕ ਕਰਕੇ ਉਹ ਅੱਗੇ ਇਨਸਾਨ ਵੱਧਦਾ ਵੈ ਔਰ ਕਈ ਪ੍ਰੋਗਰਾਮਾਂ ਵਿੱਚ ਸਾਨੂੰ ਕਾਫੀ ਚੀਜ਼ਾਂ ਵੇਖਣ ਨੂੰ ਵੀ ਮਿਲਦੀਆਂ ਹੈ ਕਿ ਜਿਹੜੀਆਂ ਸਾਡੀ ਆਉਣ ਵਾਲੀ ਪੀੜ੍ਹੀ ਵੀ ਦੇਖਦੀ ਹੈ ਕਈ ਚੀਜ਼ਾਂ ਜਿਹੜੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਆਪ ਤੋਂ ਜਾਣੂ ਨਹੀਂ ਕਰਾ ਸਕੇ ਅਤੇ ਕਿਉਂਕਿ ਉਹ ਸਾਡੇ ਘਰ ਤੋਂ ਵੀ ਲੁਪਤ ਹੋ ਚੁੱਕੀਆਂ ਹਨ ਇਸ ਕਰਕੇ ਸਰਕਾਰ ਕਲਾ ਅਤੇ ਸ਼ਿਲਪਕਾਰੀ ਦੇ ਖੇਤਰ ਵਿੱਚ ਕਾਫੀ ਕੁਛ ਕਰ ਰਹੀ ਹੈ ਅਤੇ ਬੱਚਿਆਂ ਨੂੰ ਅੱਗੇ ਜਾਗਰੂਕ ਕਰ ਰਹੀ ਹੈ